ਦੇਖੋ ਬਿਜਲੀ ਦੇ ਖਤਰੇ ਬਹੁਤ ਹਨ ਹੁਣ ਜੇਕਰ ਅਸੀਂ ਕਈ ਵਾਰੀ ਨੰਗੇ ਪੈਰ ਜਾਂ ਗਿੱਲੇ ਹੱਥਾਂ ਦੇ ਨਾਲ ਕੋਈ ਸਵਿੱਚ ਔਨ ਕਰ ਲੈਂਦੇ ਹਾਂ ਤਾਂ ਸਾਨੂੰ ਕਰੰਟ ਲੱਗਦਾ ਹੈ ਹੁਣ ਇਕੱਲੇ ਇਹ ਖਤਰੇ ਨਹੀਂ ਉਹ ਕਈ ਵਾਰੀ ਕੀ ਹੁੰਦਾ ਅਸੀਂ ਪਲੱਗ ਔਨ ਕਰਕੇ ਛੱਡ ਦਿੰਦੇ ਹਾਂ ਤਾਂ ਬੱਚੇ ਘਰਾਂ 'ਚ ਖੇਡਦੇ ਖੇਡਦੇ ਉਹਨਾਂ ਨੂੰ ਹੱਥ ਲਾ ਦਿੰਦੇ ਨੇ ਅਤੇ ਬੱਚਿਆਂ ਨੂੰ ਕਰੰਟ ਲੱਗ ਜਾਂਦਾ ਜਾਂ ਕਈ ਵਾਰੀ ਜੇ ਕੋਈ ਗਲੀ ਮੁਹੱਲੇ 'ਚ ਬਿਜਲੀ ਠੀਕ ਕਰ ਰਿਹਾ ਹੁੰਦਾ ਜੇਕਰ ਬਿਜਲੀ ਦਾ ਕਨੈਕਸ਼ਨ ਬੰਦ ਨਾ ਹੋਵੇ ਅਤੇ ਉਹਨੂੰ ਕਰੰਟ ਲੱਗ ਜਾਂਦਾ ਹੈ ਅਤੇ ਭਾਰੀ ਸੱਟਾਂ ਲੱਗਦੀਆਂ ਨੇ ਹੁਣ ਘਰਾਂ 'ਚ ਵੀ ਕਈ ਵਾਰੀ ਅਸੀਂ ਰਸੋਈਆਂ ਦੇ ਵਿੱਚ ਜਿਹੜੇ ਅਪਲਾਈਨਸ ਵਰਤਦੇ ਹਾਂ ਚਾਹੇ ਮਿਕਸੀ ਹੋ ਗਈ ਚਾਹੇ ਫਰਿੱਜ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਕਈ ਵਾਰੀ ਜਾਣੇ ਅਣਜਾਣੇ 'ਚ ਗਲਤੀ ਨਾਲ ਸਾਡੇ ਤੋਂ ਗਿੱਲੇ ਹੱਥ ਲੱਗ ਜਾਂਦੇ ਨੇ ਫਿਰ ਕਰੰਟ ਲੱਗਦਾ ਤਾਂ ਇਹਨਾਂ ਤੋਂ ਜਿਹੜੇ ਜਿਵੇਂ ਬਚਣਾ ਉਹਦੇ ਬਚਣ ਦੇ ਇਹੀ ਹੈ ਕਿ ਇੱਕ ਤਾਂ ਆਪਣੇ ਘਰਾਂ ਦੀ ਅਰਥਿੰਗ ਕਰਵਾ ਲਉ ਉੱਤੋਂ ਨੰਗੇ ਪੈਰ ਕਿਸੇ ਵੀ ਬਿਜਲੀ ਵਾਲੀ ਚੀਜ਼ ਨੂੰ ਹੱਥ ਨਾ ਲਾਉ ਕਿਉਂਕਿ ਜੇਕਰ ਉਹਦੇ 'ਚ ਕਰੰਟ ਹੋਊਗਾ ਤਾਂ ਤੁਸੀਂ ਚੱਪਲਾਂ ਪਾਈਆਂ ਹੋਣਗੀਆਂ ਤਾਂ ਤੁਹਾਨੂੰ ਕਰੰਟ ਨਹੀਂ ਲੱਗੇਗਾ ਜੇਕਰ ਕਮਰੇ 'ਚ ਬੱਚੇ ਨੇ ਤਾਂ ਧਿਆਨ ਰੱਖੋ ਕਿ ਸਾਰੇ ਪਲੱਗ ਬੰਦ ਹੋਣ ਬੱਚੇ ਕਿਸੇ ਪਲੱਗ 'ਚ ਹੱਥ ਨਾ ਦੇ ਦੇਣ ਤਾਂ ਕਿ ਉਹਨਾਂ ਨੂੰ ਕਰੰਟ ਨਾ ਲੱਗ ਜਾਵੇ ਅਤੇ ਕਮਰੇ 'ਚੋਂ ਨਿਕਲਣ ਤੋਂ ਪਹਿਲਾਂ ਜਿਵੇਂ ਲਾਈਟਾਂ ਪੱਖੇ ਬੰਦ ਕਰ ਦਿਉ ਕਈ ਵਾਰੀ ਐਂ ਹੁੰਦਾ ਕਿ ਬੜਾ ਸਮਾਂ ਕੋਈ ਚੀਜ਼ ਚੱਲ ਰਹੀ ਹੁੰਦੀ ਹੈ ਅਤੇ ਉਹ 'ਚ ਕਰੰਟ ਫੈਲ ਰਿਹਾ ਹੁੰਦਾ ਅਤੇ ਜੇਕਰ ਤੁਹਾਡੇ ਘਰ 'ਚ ਕੋਈ ਨੰਗੀਆਂ ਤਾਰਾਂ ਨੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਕਵਰ ਕਰਵਾ ਲਉ ਕਈ ਵਾਰੀ ਉਹਨਾਂ 'ਤੇ ਵੀ ਹੱਥ ਪੈਰ ਲੱਗਣ ਨਾਲ ਕਰੰਟ ਲੱਗ ਜਾਂਦਾ ਅਤੇ ਭਾਰੀ ਨੁਕਸਾਨ ਹੋ ਜਾਂਦਾ ਕਈ ਵਾਰੀ ਕਰੰਟ ਲੱਗਣ ਨਾਲ ਸਰੀਰ ਦਾ ਇੱਕ ਹਿੱਸਾ ਪੈਰਾਲਾਈਜ਼ ਵੀ ਹੋ ਜਾਂਦਾ ਅਤੇ ਕਈ ਵਾਰੀ ਅੰਗ ਵੀ ਕੱਟਣੇ ਪੈ ਜਾਂਦੇ ਨੇ ਤਾਂ ਇਹਨਾਂ ਦੇ ਨੁਕਸਾਨ ਬਹੁਤ ਨੇ ਪਰ ਜੇਕਰ ਅਸੀਂ ਸੰਭਾਲ ਕੇ ਰੱਖੀਏ ਤਾਂ ਕੋਈ ਅਸੀਂ ਬਚ ਕੇ ਰਹਿ ਸਕਦੇ ਹਾਂ